ਸਿੱਖਿਅਕ ਵਿਅਕਤੀ ਦੇ ਚੰਗੇ ਵਿਚਾਰਾਂ ਦੀ ਗੱਲ ਕਰੀਏ ਤਾਂ ਜਿਵੇਂ ਕਿ ਭਾਰਤ ਵਿੱਚ ਬਰੁਤ ਸਾਰੇ ਧਰਮ ਹਨ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਚੰਗੀਆਂ ਗੱਲਾਂ ਕਰਦਾ ਹੈ ਅਤੇ ਕਿਸੇ ਨਾਲ ਫਾਲਤੂ ਲੜਦਾ ਨਹੀਂ ਕਿਸੇ ਨਾਲ ਫਾਲਤੂ ਗੱਲਾਂ ਨਹੀਂ ਕਰਦਾ ਸਿਧਾਂਤਾਂ ਦੀ ਗੱਲ ਕਰੀਏ ਤਾਂ ਉਹ ਸਮੇਂ ਦਾ ਪਾਬੰਦ ਹੁੰਦਾ ਹੈ ਲੇਟ ਨਹੀਂ ਹੁੰਦਾ ਪ੍ਰੇਮ ਦੀ ਪਰਿਭਾਸ਼ਾ ਨਾਲ ਗੱਲ ਕਰਦਾ ਸਭ ਨਾਲ ਪ੍ਰੇਮ ਨਾਲ ਗੱਲ ਕਰਦਾ ਹੈ ਜਿਵੇਂ ਕਿ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਚੰਗਾ ਅਤੇ ਪੜ੍ਹਿਆ ਲਿਖਿਆ ਵਿਅਕਤੀ ਹੈ